ਪੰਜਾਬ ਜੋ ਕਿ ਭਾਰਤ ਦਾ ਇੱਕ ਰਾਜ ਹੈ ਇਸ ਪੰਜਾਬ ਰਾਜ ਦੇ ਵਿੱਚ ਜੋ ਕਿ ਇੱਥੇ ਰਿਹਾਇਸ਼ੀ ਇਮਾਰਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਹਨ ਕਿਉਂਕਿ ਇੱਥੇ ਬਹੁ ਬਹੁ ਪੱਖੀ ਧਾਰਮਿਕ ਲੋਕ ਰਹਿੰਦੇ ਹਨ ਅਲੱਗ ਅਲੱਗ ਧ ਧਰਮਾਂ ਦੇ ਲੋਕ ਰਹਿੰਦੇ ਹਨ ਸੋ ਇੱਥੇ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਪੁਰਾਣੀਆਂ ਨਵੀਆਂ ਬਿਲਡਿੰਗਾਂ ਤੁਹਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ ਪੁਰਾਣੀਆਂ ਬਿਲਡਿੰਗਾਂ ਸੌ ਸੌ ਪੁਰਾਣੇ ਸੌ ਸੌ ਸਾਲ ਪੁਰਾਣੀਆਂ ਬਿਲਡਿੰਗਾਂ ਵੀ ਤੁਹਾਨੂੰ ਮਿਲ ਜਾਂਦੀਆਂ ਹਨ ਦੇਖਣੀਆਂ ਘਰ ਜੋ ਕਿ ਨਾਨਕਸ਼ਾਹੀ ਇੱਟ ਤੋਂ ਵੀ ਬਣੇ ਹੁੰਦੇ ਹਨ ਜਿੱਥੇ ਜਾ ਕੇ ਇੱਕ ਬਹੁਤ ਵਧੀਆ ਅਹਿਸਾਸ ਅਨੁਭਵ ਹੁੰਦਾ ਹੈ ਪੁਰਾਣੇ ਸਮੇਂ ਦਾ ਅਤੇ ਨਵੀਆਂ ਨਵੀਆਂ ਕੋਠੀਆਂ ਵੀ ਖਾਸ ਕਰ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਵੱਡੀਆਂ ਵੱਡੀਆਂ ਨਵੀਆਂ ਨਵੀਆਂ ਕੋਠੀਆਂ ਦੇਖਣ ਨੂੰ ਮਿਲਦੀਆਂ ਹਨ ਜੋ ਕਿ ਤਿੰਨ ਤਿੰਨ ਮੰਜ਼ਿ ਤਿੰਨ ਤਿੰਨ ਮੰਜ਼ਿਲਾਂ ਜਿਨ੍ਹਾਂ ਦੀ ਹੁੰਦੀਆਂ ਹਨ ਕਰੋੜ ਕਰੋੜ ਰੁਪਏ ਦੀਆਂ ਵੀ ਬਣੀਆਂ ਹੁੰਦੀਆਂ ਹਨ ਅਤੇ ਅਲੱਗ ਅਲੱਗ ਧਰਮਾਂ ਦੇ ਜੋ ਕਿ ਗੁਰਦੁਆਰੇ ਬਹੁਤ ਪੁਰਾਣੇ ਮਿਲ ਜਾਂਦੇ ਹਨ ਨਵੇਂ ਗੁਰਦੁਆਰੇ ਵੀ ਬਣ ਰਹੇ ਹਨ ਮੰਦਰ ਬਹੁਤ ਪੁਰਾਣੇ ਵੀ ਮਿਲ ਜਾਂਦੇ ਹਨ ਨਵੇਂ ਮ ਨਵੇਂ ਵੀ ਬਣ ਰਹੇ ਹਨ